ਪੰਛੀ ਸਾਰੇ ਵੱਡੇ ਅਤੇ ਛੋਟੇ ਵੇਹੜਿਆਂ ਜਾਂ ਬਾਗਾਂ 'ਤੇ ਨਿੱਕੇ ਨਿੱਕੇ ਬਾਲ ਹਨ ਉਹ ਆਪਣੇ ਸ਼ਾਨਦਾਰ ਰੰਗ ਅਤੇ ਰੰਗ ਨਾਲ ਸਾਡੇ ਜੀਵਨ ਵਿੱਚ ਸੁੱਖ ਅਤੇ ਪਰਿਵਾਰਿਕ ਸੰਤੋਖ ਦੀ ਭਾਵਨਾ ਪੈਦਾ ਕਰਦੇ ਹਨ ਇਸ ਨਾਲ ਪੰਛੀਆਂ ਦੇ ਚੌਹ ਵੇਲੇ ਆਤਮਿਕ ਅਨੁਭਵ ਅਤੇ ਜੀਵਨ ਦੇ ਸੰਬੰਧ ਅੰਦਰ ਅੰਤਰ ਵਧਾਉਂਦੇ ਹਨ ਇਹ ਲੋਕ ਆ ਲੋਕ ਆਮ ਤੌਰ 'ਤੇ ਇਹਨਾਂ ਦੀ ਸੇਵਾ ਅਤੇ ਇਹਨਾਂ ਦੇ ਰੱਖਵਾਂ ਨੂੰ ਰਾਖਵੇਂਕਰਨ ਨੂੰ ਅਧਿਕ ਮੁਦਰਾ ਵਿੱਚ ਕਰਨ ਲਈ ਉਹਨਾਂ ਨੂੰ ਅਨਾਜ ਪਾਣੀ ਅਤੇ ਉਚਿਤ ਸ਼ੇਅਰ ਪ੍ਰੋਵਾਈਡ ਕਰਦੇ ਹਨ ਵਿਹੜੇ ਜਾਂ ਬਾਗ ਵਿੱਚ ਪੰਛੀਆਂ ਦੇ ਅਹਾਰ ਅਤੇ ਸਾਫ ਪਾਣੀ ਸ਼ੁਰੂਆਤ ਹੁੰਦੀ ਹੈ ਧਰਤੀ ਦੇ ਸਮੁੰਦਰੀ ਪਾਣੀ ਨੂੰ ਹਾਲ ਵਿ ਹਾਲ ਵਿੱਚ ਰੱਖਿਆ ਜਾ ਸਕਦਾ ਹੈ ਜਿਸ ਨਾਲ ਪੰਛੀਆਂ ਨੂੰ ਨਾਲਿਆਂ ਵਿੱਚੋਂ ਸ਼ਿਕਾਰ ਲਈ ਆਸਾਨੀ ਮਿਲਦੀ ਹੈ ਇਸ ਤਰ੍ਹਾਂ ਵਧੀਆ ਜਾਨਵਰ ਸਵੇਰੇ ਨੂੰ ਸਾਫ ਪਾਣੀ ਦੀ ਤਲਬ ਕਰਦੇ ਹਨ ਅਤੇ ਉਹਨਾਂ ਨੂੰ ਅਹਾਰ ਪ੍ਰਾਪਤ ਕਰਨ ਲਈ ਮਦਦ ਕਰਦੇ ਹਨ ਉਹਨਾਂ ਦੀ ਜੀਵਨ ਸ਼ੈਲੀ ਅਤੇ ਸਿਹਤ ਵਾਸਤੇ ਮੂਲ ਬੋਧ ਅਹਾਰ ਪ੍ਰਦਾਨ ਕਰਦੇ ਹਾਂ ਪੰਛੀਆਂ ਦੇ ਅਨਾਜ ਦੇ ਸਿਹਾ ਬੀਜ ਅਤੇ ਨਾਜੀ ਪ੍ਰੋਡਕਟ ਨੂੰ ਦੀ ਜੀਵਨੀ ਨੂੰ ਪ੍ਰਾਪਤ ਕਰਦੇ ਹੋਏ ਪ੍ਰਸਿੱਧ ਹਨ ਇਹ ਪੰਛੀਆਂ ਨੂੰ ਪ੍ਰੋਟੀਨ ਵਿਟਾਮਿਨ ਅਤੇ ਜ਼ਰੂਰੀ ਤੌਰ 'ਤੇ ਸੰਭਾਲਿਆ ਰਹਿੰਦੇ ਹਨ ਇਸ ਤਰਾਂ ਪੰਛੀਆਂ ਨੂੰ ਇਹ ਸਮਰੱਥਾ ਮਿਲਦੀ ਹੈ ਕਿ ਉਹ ਸਿਹਤਮੰਦ ਅਤੇ ਸਹਿਯੋਗੀ ਹੋਣ ਆਪਣੇ ਵਿਹੜੇ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਪਾਣੀ ਅਤੇ ਅਨਾਜ ਨੂੰ ਰੱਖਣਾ ਜ਼ਰੂਰੀ ਹੈ ਉਹਨਾਂ ਦੀ ਸਿਹਤ ਅਤੇ ਸੁੱਖ ਵਿੱਚ ਸਹਿਯੋਗ ਕਰਦੇ ਹਨ ਅਸੀਂ ਪੰਛੀਆਂ ਦੀ ਸੁਰੱਖਿਆ ਅਤੇ ਕਲੱਬ ਦੀ ਸੁੰਦਰਤਾ ਬਣਾਉਣ ਵਿੱਚ ਵੀ ਮਦਦ ਕਰਦੇ ਹਾਂ